ਪਿਛਲੇ ਹੀ ਸਾਲ ਮੈਂ ਆਪਣੀ ਫਰੈਂਡ ਨਾਲ਼ ਇੱਕ ਹਿਮਾਚਲ ਗਈ ਘੁੰਮਣ ਫਿਰਨ ਵਾਸਤੇ ਉਹ ਉੱਥੇ ਦੀ ਹੀ ਸੀ ਜਦੋਂ ਮੈਂ ਉੱਥੇ ਗਈ ਉੱਥੇ ਦਾ ਸੱਭਿਆਚਾਰ ਖਾਣਾ ਪੀਣਾ ਪਹਿਰਾਵਾ ਬਹੁਤ ਹੀ ਅਲੱਗ ਸੀ ਅਤੇ ਬਹੁਤ ਹੀ ਵਧੀਆ ਸੀ ਉੱਥੋਂ ਦੇ ਲੋਕਾਂ ਨੇ ਸਾਡਾ ਬਹੁਤ ਹੀ ਸਨਮਾਨ ਕੀਤਾ ਅਤੇ ਬਹੁ ਸਾਡਾ ਬਹੁਤ ਹੀ ਧਿਆਨ ਰੱਖਿਆ ਸਾਨੂੰ ਖਾਣ ਪੀਣ ਦੀ ਸਹੂਲਤ ਬਹੁਤ ਹੀ ਵਧੀਆ ਤਰੀਕੇ ਨਾਲ਼ ਪੈ ਦਿੱਤੀ ਅਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਹੀ ਵਧੀਆ ਤਰੀਕੇ ਨਾਲ਼ ਸਾਡਾ ਉੱਥੇ ਅਟਰੈਕਸ਼ਨ ਹੋਈ